ਅਸੀਂ ਦੇਖਦੇ ਹਾਂ ਕਿ ਸਾਡੇ ਪੰਜਾਬ ਵਿੱਚ ਬਹੁਤ ਸਾਰੀਆਂ ਖੇਡਾਂ ਹਨ ਅਤੇ ਸਕੂਲਾਂ ਵਿੱਚ ਵੀ ਸਾਨੂੰ ਬਹੁਤ ਸਾਰੀਆਂ ਖੇਡਾਂ ਖੇਡਾਈਆਂ ਜਾਂਦੀਆਂ ਸੀ ਸਾਡਾ ਇੱਕ ਪੀਰੀ ਪੀਰੀਅਡ ਹੀ ਲੱਗਦਾ ਸੀ ਵੱਖਰਾ ਗੇਮਸ ਪੀਰਡ ਜਿਹੜੇ ਬੱਚੇ ਨੇ ਉਹਦੇ 'ਚ ਹਿੱਸਾ ਲੈਣਾ ਲੈ ਲੈਂਦੇ ਸੀ ਕੋਈ ਖੋ ਖੋ 'ਚ ਲੈਂਦਾ ਸੀ ਕੋਈ ਕਬੱਡੀ ਵਿੱਚ ਕੋਈ ਕ੍ਰਿਕਟ ਵਿੱਚ ਕੋਈ ਵੋਲੀਬੋਲ ਵਿੱਚ ਸਾਰੇ ਸਾਰੀਆਂ ਖੇਡਾਂ ਹੀ ਸਕੂਲ ਵਿੱਚ ਹੁੰਦੀਆਂ ਸੀ ਕੋਈ ਬੈਡਮਿੰਟਨ ਖੇਡਦਾ ਸੀ ਜਿਹਨੂੰ ਜਿਹਦੇ ਵਿੱਚ ਰੁਚੀ ਹੁੰਦੀ ਸੀ ਜਿਹਦੇ 'ਚ ਵੀ ਜਿਹਦਾ ਦਿਲ ਕਰਦਾ ਸੀ ਵੀ ਹਾਂ ਸਾਨੂੰ ਆਹ ਵਧੀਆ ਲੱਗਦਾ ਹੈ ਉਹਦੇ ਵਿੱਚ ਆਪਦਾ ਮਨੋਰੰਜਨ ਸਾਰੇ ਕਰਦੇ ਸੀ ਅਤੇ ਛੋਟੇ ਹੁੰਦੇ ਅਸੀਂ ਬਾਂਦਰ ਕਿੱਲਾ ਛਿੱਤਰ ਕਿਲਾ ਇਹ ਵਾਲੇ ਖੇਡ ਵੀ ਖੇਡਦੇ ਸੀ ਜਿਹਦੇ 'ਚ ਚੱਕਰ ਬਣਾ ਕੇ ਸਾਰੀਆਂ ਚੱਪਲਾਂ ਰੱਖ ਦੇਣੀਆਂ ਹੈਗੀਆਂ ਅਤੇ ਉਹਦੇ 'ਚ ਸਾਨੂੰ ਬਹੁਤ ਮਜ਼ਾ ਆਉਂਦਾ ਸੀਗਾ ਅਤੇ ਵੱਡੇ ਹੋ ਕੇ ਜਦੋਂ ਸਕੂਲ ਜਾਣ ਲੱਗ ਗਏ ਤਾਂ ਫਿਰ ਸਕੂਲ ਵਿੱਚ ਸਕੂਲ 'ਚ ਹੋਰ ਹੋਰ ਖੇਡਾਂ ਸਾਨੂੰ ਬਹੁਤ ਬਹੁਤ ਹੋਰ ਹੋਰ ਖੇਡਾਂ ਦਾ ਸਾਨੂੰ ਬਹੁਤ ਨੋਲੇਜ ਸਾਡੀ ਵਧੀ ਉਹਦੇ ਨਾਲ ਜਿਵੇਂ ਕਿ ਕ੍ਰਿਕਟ ਹੋ ਗਿਆ ਖੋ ਖੋ ਹੋ ਗਈ ਖੋ ਖੋ ਅਤੇ ਕਬੱਡੀ ਉਹਦੇ 'ਚ ਸਾਨੂੰ ਉਹਦੇ 'ਚ ਸਾਨੂੰ ਬਰਫ ਪਾਣੀ ਵੀ ਖਿਡਾਉਂਦੇ ਸੀਗੇ ਜਾਂ ਬਰਫ ਪਾਣੀ ਜਾਂ ਇੱਕ ਲੰਗੜੀ ਰੇਸ ਲਵਾ ਤੀ ਸਾਨੂੰ ਕਦੇ ਲੰਗੜੀ ਰੇਸ ਲਵਾ ਦੇਣੀ ਹੈਗੀ ਜੇ ਉਹਦੇ 'ਚ ਸਾਨੂੰ ਬਹੁਤ ਮਜ਼ਾ ਆਉਂਦਾ ਸੀਗਾ